ਮੈਂ ਆਪਣੇ ਫ਼ਰੈਡ ਦੇ ਕਹੇ 'ਤੇ ਸ਼ੂਜ਼ ਆਰਡਰ ਕਰੇ ਸੀ ਕਿਉਂਕਿ ਉਹਨੇ ਕਿਹਾ ਸੀ ਕਿ ਬਹੁਤ ਵਧੀਆ ਹੁੰਦੇ ਹੈ ਬਟ ਮੈਂ ਹੁਣ ਮੰਗਵਾਏ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਦੇਰ ਚੱਲਣਗੇ ਹੁਣ ਇਹਨੂੰ ਲਏ ਨੂੰ ਮੈਨੂੰ ਦੋ ਕੁ ਮਹੀਨੇ ਹੋ ਗਏ ਹੁਣੀ ਇਹਤੋਂ ਇਹਦੀ ਸੌਲ਼ ਉੱਧੜਨੀ ਸ਼ੁਰੂ ਹੋ ਗਈ ਔਰ ਇਹਦੀ ਲੇਸ਼ਿਜ਼ ਵੀ ਇੱਕ ਟੁੱਟ ਗਿਆ ਹੈਗਾ ਹੈ ਔਰ ਥੱਲੇ ਤੋਂ ਇਹਦੀ ਸੌਲ਼ ਜਮ੍ਹਾਂ ਹੀ ਉੱਧੜ ਚੱਲੀ ਔਰ ਘਿੱਸ ਚੱਲੀ ਹੁਣ ਇਹ ਸਲਿੱਪ ਹੁੰਦੇ ਹੈ ਇਹਦੇ ਔਰ ਇਹਦੇ ਨਾਲ ਗਿਰਨ ਦਾ ਵੀ ਡਰ ਹੈਗਾ ਹੁਣ ਲੱਤ ਪੈਰ ਟੁੱਟ ਜਾਣੀ ਔਰ ਮਤਲਬ ਕਿ ਸਹੀ ਨਹੀਂ ਹੈਗੇ ਮੇਰੇ ਪੈਸੇ ਬਰਬਾਦ ਹੈਗੇ ਇਹ